ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਲੋਕ ਆਪਣੇ ਮਹਿਮਾਨਾਂ ਦੀ ਆਓ ਭਗਤੀ ਕਰਨ ਲਈ ਬਹੁਤ ਹੀ ਮਸ਼ਹੂਰ ਹਨ ਅਤੇ ਇਹ ਪੰਜਾਬ ਦੇ ਲੋਕ ਆਪਣੇ ਘਰ ਆਏ ਮਹਿਮਾਨਾਂ ਨੂੰ ਸਿਰ ਮੱਥੇ 'ਤੇ ਚੱਕ ਕੇ ਬਿਠਾਉਂਦੇ ਹਨ ਐਵੇਂ ਹੀ ਜਦੋਂ ਸਾਡੇ ਘਰ ਕੋਈ ਮਹਿਮਾਨ ਆਵੇ ਤਾਂ ਮੈਂ ਉਹਨਾਂ ਨੂੰ ਖੁਸ਼ ਚਿਹਰੇ ਨਾਲ ਮਿਲਦੀ ਹਾਂ ਅਤੇ ਉਹਨਾਂ ਦੀ ਆਓ ਭਗਤ ਕਰਦੀ ਹਾਂ ਅਤੇ ਹਮੇਸ਼ਾਂ ਹੀ ਉਹਨਾਂ ਦੀ ਸੇਵ ਸੇਵਾ ਕਰਦੀ ਹਾਂ ਤਾਂ ਸੇ ਤਾਂ ਕਿ ਸੇਵਾ ਵਿੱਚ ਕੋਈ ਕਮੀ ਨਾ ਰਹਿ ਜੇ ਇਸ ਲਈ ਮੈਂ ਹਮੇਸ਼ਾਂ ਹੀ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਕੋਈ ਸਾਡੇ ਘਰ 'ਚ ਆਉਂਦਾ ਹੈ ਆਪਾਂ ਉਹਨਾਂ ਨੂੰ ਚਾਹ ਬਣਾਉਂਦੇ ਹਾਂ ਫਿਰ ਚਾਹ ਨਾਲ ਪੰਜਾਬੀਆਂ ਦਾ ਮਸ਼ਹੂਰ ਹੈ ਕਿ ਆਪਾਂ ਉਹਨਾਂ ਨੂੰ ਪਕੌੜੇ ਪਾਲਕ ਦੇ ਪਕੌੜੇ ਪਨੀਰ ਦੇ ਪਕੌੜੇ ਜਾਂ ਫਿਰ ਆਪਾਂ ਬ੍ਰੈਡ ਪਕੌੜੇ ਬਣਾ ਕੇ ਖਵਾਉਂਦੇ ਹਾਂ ਉਸ ਤੋਂ ਬਾਅਦ ਜੇ ਘਰ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਰੋਟੀ ਲਈ ਵੀ ਕਹਿੰਦੇ ਹਾਂ ਰੋਟੀ 'ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਬੜੀਆਂ ਮਸ਼ਹੂਰ ਹਨ ਜਿਵੇਂ ਪੰਜਾਬ 'ਚ ਦਾਲ ਮੱਖਣੀ ਮਟਰ ਪਨੀਰ ਹੈ ਨਾ ਇਹ ਅਤੇ ਸਾਗ ਤਾਂ ਮਸ਼ਹੂਰ ਏ ਆ ਅਤੇ ਮੱਕੀ ਰੋਟੀ ਇਹ ਸਾਰੀਆਂ ਅਗਲਿਆਂ ਨੂੰ ਪੁੱਛਦੇ ਹਾਂ ਤਾਂ ਬਣਾਉਂਦੇ ਹਾਂ ਚੀਜ਼ ਕਈ ਤਰ੍ਹਾਂ ਦੀਆਂ ਸਵਾਦਿਸ਼ਟ ਸਬਜ਼ੀਆਂ ਅਤੇ ਰੋਟੀ ਚੌਲ਼ ਹੈ ਨਾ ਕਈ ਵਾਰੀ ਪਲਾਓ ਵੀ ਬਣਾਉਂਦੇ ਹਾਂ ਪਲਾਓ ਬਣਾ ਕੇ ਸੇਵਾ ਕਰਦੇ ਹਾਂ ਜਾਂ ਫਿਰ ਉਸ ਤੋਂ ਬਾਅਦ ਰੋਟੀ ਤੋਂ ਬਾਅਦ ਆਪਾਂ ਉਹਨਾਂ ਨੂੰ ਕੋਈ ਮਿੱਠੀ ਚੀਜ਼ ਵੀ ਪੇਸ਼ ਕਰਨੀ ਹੁੰਦੀ ਆ ਮਿੱਠੀ ਚੀਜ਼ 'ਚ ਜਿਵੇਂ ਸੇਵੀਆਂ ਬਣਾ ਲਈ ਦੀਆਂ ਏ ਖੀਰ ਬਣਾ ਕੇ ਪਕਾ ਕੇ ਖਵਾਈ ਦੀ ਆ ਮਹਿਮਾਨਾਂ ਨੂੰ ਤਾਂ ਕਿ ਉਹ ਖੁਸ਼ ਹੋ ਜਾਣ ਕਈ ਵਾਰੀ ਅੱਜ ਕੱਲ੍ਹ ਬੱਚਿਆਂ ਨੂੰ ਖੂਬ ਬੱਚੇ ਮੈਂ ਆਉਂਦੇ ਨੇ ਜਿਹੜੇ ਮਹਿਮਾਨਾਂ ਨਾਲ ਉਹਨਾਂ ਨੂੰ ਅੱਜ ਕੱਲ੍ਹ ਫਾਸਟ ਫੂਡ ਪਸੰਦ ਹੈ ਤਾਂ ਮੈਗੀ ਬਣਾ ਦਉ ਜੀ ਹੈ ਨਾ ਇਹੋ ਜਿਹੀਆਂ ਸਮਾਈਲੀਆਂ ਬਣਾ ਦਉ ਇਹ ਚੀਜ਼ਾਂ ਵੀ ਬਹੁਤ ਪਕਾ ਕੇ ਖਵਾਈਆਂ ਜਾਂਦੀਆਂ ਮਹਿਮਾਨਾਂ ਨੂੰ ਤਾਂ ਕਿ ਲੋਕ ਖੁਸ਼ ਮਹਿਮਾਨ ਖੁਸ਼ ਹੋ ਕੇ ਜਾਣ ਅਤੇ ਖੁਸ਼ੀ ਖੁਸ਼ੀ ਸਾਡੇ ਘਰ ਫਿਰ ਆਉਣ